ਰੋਜ਼ਾਨਾ ਜੀਵਨ ਵਿੱਚ ਆਪਾਂ ਜੇ ਗੱਲ ਕਰੀਏ ਤਕਨੀਕੀ ਸਾਧਨਾਂ ਦੀ ਤਾਂ ਸਭ ਤੋਂ ਵੱਡੀ ਉਦਾਹਰਨ ਤਾਂ ਇਹਦੀ ਫੋਨ ਹੀ ਹੈ ਫੋਨ ਤੋਂ ਇਲਾਵਾ ਆਪਾਂ ਜੇ ਘਰੇਲੂ ਕੰਮਾਂ ਦੇ ਵਿੱਚ ਦੇਖੀਏ ਤਾਂ ਅੱਜ ਕੱਲ੍ਹ ਮਾਈਕ੍ਰੋਵੇਵ ਆ ਗਏ ਆ ਹੈ ਨਾ ਅਵਨ ਹੋ ਗਏ ਬਾਕੀ ਪੋਚੇ ਲਈ ਆਪਾਂ ਦੇਖ ਲਈਏ ਹੈ ਨਾ ਪੋਚਿਆਂ ਲਈ ਵੀ ਉਹ ਬੱਕਟ ਦੇ ਨਾਲ ਉਹ ਪੋਚਾ ਆਉਂਦਾ ਹੈ ਨਾ ਤਾਂ ਇਹ ਮਤਲਬ ਬਹੁਤ ਇੱਦਾਂ ਦੇ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਹੈ ਨਾ ਜਿਹਦੇ ਨਾਲ ਆਪਣੀ ਰੋਜ਼ਾਨਾ ਜੀਵਨ ਆ ਹੈ ਨਾ ਜਿਹੜਾ ਵੀ ਕਿਤੇ ਨਾ ਕਿਤੇ ਬਹੁਤ ਸੁਖਾਲਾ ਹੋ ਗਿਆ ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਹੁਣ ਕਈ ਜਿਵੇਂ ਦੁਕਾਨਾਂ ਨੇ ਹੈ ਨਾ ਬਾਹਰ ਆਪਣਾ ਕੋਈ ਵੀ ਫੈਕਟਰੀਆਂ ਵਗੈਰਾ ਨੇ ਉੱਥੇ ਕੀ ਹੈ ਵੀ ਹੁਣ ਕਿੱਥੇ ਦਾ ਪਹਿਲਾਂ ਵੀ ਇੰਨੇ ਮਜ਼ਦੂਰਾਂ ਦੀ ਭਰਤੀ ਕੀਤੀ ਜਾਂਦੀ ਸੀ ਹੁਣ ਕਿਤੇ ਨਾ ਕਿਤੇ ਇੰਨੀ ਜ਼ਿਆਦਾ ਤਕ ਤਕਨੀਕਾਂ ਆ ਗਈਆਂ ਹੈ ਨਾ ਵੀ ਟੈਕਨੋਲਜੀ ਇੰਨੀ ਵੱਧ ਗਈ ਆ ਹੁਣ ਕਿਤੇ ਨਾ ਕਿਤੇ ਬੰਦਿਆਂ ਨੂੰ ਰਿਪਲੇਸ ਕਰਕੇ ਉਹ ਮਸ਼ੀਨਾਂ ਦਾ ਸਹਾਰਾ ਲੈ ਕੇ ਵੀ ਉੱਥੇ ਮਤਲਬ ਉਹ ਮੈਨਪਾਵਰ ਆ ਜਿਹੜੀ ਉਹ ਘੱਟ ਗਈ ਹੈ ਤਾਂ ਇੱਥੇ ਕੀ ਹੈ ਵੀ ਹੁਣ ਵੀ ਪਹਿਲਾਂ ਇੰਨਾਂ ਜ਼ਿਆਦਾ ਟਾਈਮ ਲੱਗਦਾ ਸੀ ਹੁਣ ਉਹ ਜ਼ਿਆਦਾ ਦੇਰ ਵਾਲਾ ਕੰਮ ਆ ਜਿਹੜਾ ਬਹੁਤ ਮਤਲਬ ਛੇਤੀ ਅਤੇ ਸੁਖਾਲੇ ਤਰੀਕੇ ਨਾਲ ਹੋ ਜਾਂਦਾ ਇਸ ਤਰੀਕੇ ਨਾਲ ਦੇਖੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਨੌਕਰੀਆਂ ਦੀ ਕਮੀ ਤਾਂ ਜ਼ਰੂਰ ਹੈਗੀ ਹੈਗੀ ਹੈ ਪਰ ਇਸ ਦੇ ਵਿੱਚ ਕੀ ਟਾਈਮ ਬਹੁਤ ਬਚ ਜਾ ਰਿਹਾ ਹੈਗਾ ਟਾਈਮ ਦੇ ਨਾਲ ਇਲਾਵਾ ਮਤਲਬ ਵੀ ਮਤਲਬ ਸਾਧਨ ਘੱਟ ਲੱਗ ਰਹੇ ਨੇ